ਪੰਜਾਬ ਵਿੱਚ ਆਪਣਾ ਸਟਾਰਟਅੱਪ ਕੰਪਨੀਆਂ ਜਿਵੇਂ ਚਾਏ ਸੂਟਾ ਵਾਰ ਅਤੇ ਦੇਸੀ ਚਾਏ ਇਹੀ ਜੀ ਕਰਕੇ ਇੱਕ ਹੋਰ ਕੰਪਨੀ ਆ ਅਤੇ ਇਹ ਸਟਾਰਟਅੱਪ ਕੰਪਨੀਆਂ ਹੈਗੀਆਂ ਨੇ ਅਤੇ ਇਹ ਆਪਣਾ ਜਿਵੇਂ ਅਲੱਗ ਅਲੱਗ ਸ਼ਹਿਰਾਂ ਚ ਅਲੱਗ ਅਲੱਗ ਉਹਨਾਂ 'ਚ ਇਹਨਾਂ ਦਾ ਹੈਗਾ ਏ ਆਊਟਲੈਟ ਅਤੇ ਪੰਜਾਬ ਦੇ ਲੋਕਾਂ ਨੂੰ ਇਹ ਰੁਜ਼ਗਾਰ ਵੀ ਦੇ ਰਹੀਆਂ ਨੇ ਜਿਹਨਾਂ 'ਚ ਅਲੱਗ ਅਲੱਗ ਇਹਨਾਂ 'ਚ ਘੱਟੋ ਘੱਟ ਪੰਜਾਹ ਸੱਠ ਲੋਕ ਕੰਮ ਕਰਦੇ ਆ ਅਤੇ ਇਹਨਾਂ ਕੋਲ ਸ਼ਾਮ ਨੂੰ ਭੀੜ ਵੀ ਹੁੰਦੀ ਆ ਅਤੇ ਲੋਕ ਆਉਂਦੇ ਵੀ ਨੇ ਵਧੀਆ ਵੀ ਲੱਗਦਾ ਲੋਕਾਂ ਨੂੰ ਅਤੇ ਇਹ ਪੰਜਾਬ ਨੂੰ ਜਿਵੇਂ ਟੈਕਸ ਵਗੈਰਾ ਦੇ ਕੇ ਇਹ ਉਹਨਾਂ 'ਚ ਵੀ ਪੰਜਾਬ ਨੂੰ ਸਹਿਯੋਗ ਦੇ ਰਹੇ ਨੇ ਅਤੇ ਇਹੇ ਜਿਹੀਆਂ ਕੰਪਨੀਆਂ ਹੈਗੀਆਂ ਨੇ ਜਿਹੜੀਆਂ ਇੱਥੇ ਸਟਾਰਟਅੱਪ ਕੰਪਨੀਆਂ ਨੇ